ਸਾਡੇ ਖੇਤਰ ਵਿੱਚ ਵੱਖ ਵੱਖ ਧਰਮਾਂ ਦੇ ਭਾਈਚਾਰਿਆਂ ਦੇ ਲੋਕ ਰਹਿੰਦੇ ਹੈ ਬੜੇ ਅੱਛੇ ਮਿਲਣਸਾਰ ਨੇ ਪਰ ਸਭ ਤੋਂ ਮੀਡੀਆ ਦਾ ਜਿਹੜਾ ਰੋਲ ਹੈ ਨਿਊਜ਼ ਮੀਡੀਆ ਦਾ ਰੋਲ ਬਹੁਤ ਅੱਛਾ ਹੈ ਤਾਂ ਸਾਰਾ ਭਾਈਚਾਰਾ ਬਣਿਆ ਰਹੇ ਇਸ ਤਰ੍ਹਾਂ ਦੀਆਂ ਖਬਰਾਂ ਦਿੰਦੇ ਨੇ ਔਰ ਉਹਨਾਂ ਦਾ ਡਿਟੇਲ ਦੇ ਵਿੱਚ ਵੀ ਉਹਨੂੰ ਮਿਲਾਉਣ ਦੀ ਕੋਸ਼ਿਸ਼ ਕਰਦੇ ਨੇ ਕੋਈ ਕੋਈ ਐਸਾ ਮੀਡੀਆ ਹੁੰਦਾ ਹੈ ਜੋ ਪੋਜ਼ਟਿਵ ਤਰੀਕੇ ਦੇ ਨਾਲ ਨਿਊਜ਼ ਨਹੀਂ ਦਿੰਦਾ ਜਿਹਦੇ ਨਾਲ ਫਰਕ ਪੈਂਦਾ ਪਰ ਸਾਡੇ ਇਲਾਕੇ ਵਿੱਚ ਐਸਾ ਕੋਈ ਨਹੀਂ ਹੈ ਸਾਡੇ ਇਲਾਕੇ ਜੋ ਨਿਊ ਚੈਨਲ ਹੈ ਜਾਂ ਮੀਡੀਆ ਦੇ ਔਰ ਵੀ ਜੋ ਜੋ ਸਾਧਨ ਹੈ ਉਹਨਾਂ ਦੇ ਵਿੱਚ ਭਾਈਚਾਰਿਆਂ ਬਣਾਉਣ ਲਈ ਮੀਡੀਆ ਦੀ ਬਹੁਤ ਹੈਲਪ ਹੁੰਦੀ ਹੈ